ਦੇਖੋ ਜੀ ਐਥਲੀਟ ਨੂੰ ਸਿਖਲਾਈ ਦੇਣ ਲਈ ਨਾ ਸਾਡੇ ਤਾਂ ਜੀ ਜ਼ਿਲ੍ਹੇ ਵਿੱਚ ਇੱਕ ਏ ਜਗ੍ਹਾ ਹੈ ਸਿਰਫ਼ ਮੋਹਾਲੀ ਓ ਜਿੱਥੇ ਕਿ ਅਲੱਗ ਅਲੱਗ ਸਟੇਟਾਂ ਦੇ ਜੀ ਐਥਲੀਟ ਆਉਂਦੇ ਨੇ ਜਿਵੇਂ ਕਿ ਹਿਮਾਚਲ ਹੋ ਗਿਆ ਜੀ ਹਰਿਆਣਾ ਹੋ ਗਿਆ ਅਤੇ ਹੋਰ ਵੀ ਕਈ ਰਾਜਾਂ ਦੇ ਐਥਲੀਟ ਨੇ ਜੋ ਕਿ ਉੱਥੇ ਆਉਂਦੇ ਨੇ ਧੰਨਵਾਦ ਜੀ